ਸੈਲਫ ਹੈਲਪ ਗਰੁੱਪ ਇਨਫੋਰਮਲ ਗਰੁੱਪ ਹੈ ਜੋ ਕਿ ਲੋਕਾਂ ਵੱਲੋਂ ਆਪਸੀ ਭਾਈ ਚਾਰੇ ਕਰਕੇ ਆਪ ਹੀ ਤਿਆਰ ਕੀਤੇ ਗਏ ਹਨ ਜੋ ਵੱਖ ਵੱਖ ਤਰ੍ਹਾਂ ਦੇ ਨੌਜਵਾਨ ਇਕੱਠੇ ਕਰਕੇ ਉਹਨਾਂ ਨੂੰ ਉਹਨਾਂ ਦਾ ਕਰਕੇ ਅਤੇ ਫੇਰ ਇਨਫੋਰਮਲ ਗਰੁੱਪ ਬਣਾਏ ਗਏ ਹਨ ਜਿਹਦੇ ਵਿੱਚ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਸ਼ੇਅਰ ਕਰ ਸਕਦੇ ਹਨ ਹਰ ਇੱਕ ਦੀ ਮਦਦ ਕਰ ਸਕਦੇ ਹਨ ਹਰ ਕਿਸੇ ਦਾ ਮੁੱਦਾ ਹੱਲ ਕਰ ਸਕਦੇ ਹਨ ਬਾਕੀ ਇਹਦੇ ਵਿੱਚ ਔਰਤਾਂ ਦੇ ਹੱਕ ਲਈ ਔਰਤਾਂ ਦੇ ਜੈਂਡਰ ਲਈ ਗੱਲ ਕੀਤੀ ਗਈ ਹੈ ਜੋ ਕਿ ਇਹ ਹੈ ਕਿ ਹਰ ਇੱਕ ਔਰਤ ਨੂੰ ਪਿੱਛੇ ਹੱਟਣਾ ਨਹੀਂ ਚਾਹੀਦਾ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਔਰਤਾਂ ਵੀ ਮਰਦਾਂ ਨਾਲੋਂ ਘੱਟ ਨਹੀਂ ਹਨ ਉਹਨਾਂ ਨੂੰ ਵੀ ਹਰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਧੰਨਵਾਦ